ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਪ੍ਰਸਿੱਧ ਹੈ ਪਰ ਜਿਵੇਂ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਖੇਡਾਂ ਦੇ ਵੀ ਟੂਰਨਾਮੈਂਟ ਬਹੁਤ ਸਾਰੇ ਹੁੰਦੇ ਹੈ ਜਿਵੇਂ ਆਪਾਂ ਕਬੱਡੀ ਆ ਕਬੱਡੀ ਦੇ ਟੂਰਨਾਮੈਂਟ ਸਾਡੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ ਜਿੱਥੋਂ ਦੂਰੋਂ ਦੂਰੋਂ ਜੋ ਖੇਡ ਹੈ ਕਬੱਡੀ ਖੇਡ ਹੈ ਉਹ ਦੇਖਣ ਦੇ ਲਈ ਲੋਕ ਆਉਂਦੇ ਆ ਇਕੱਤਰਿਤ ਹੁੰਦੇ ਆ ਅਤੇ ਜਿਵੇਂ ਸਾਡੇ ਮੇਰਾ ਜੱਦੀ ਪਿੰਡ ਹੈ ਅਸੀਂ ਉੱਥੇ ਮੈਂ ਆਪਣੀ ਫੈਮਲੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਉੱਥੇ ਜਦੋਂ ਕਬੱਡੀ ਦਾ ਟੂਰਨਾਮੈਂਟ ਹੁੰਦਾ ਆ ਅਸੀਂ ਉੱਥੇ ਦੇਖਣ ਜਾਂਦੇ ਐਂ ਉੱਥੇ ਬਹੁਤ ਸਾਰੇ ਪਲੇਅਰਸ ਆ ਜਿਹੜੇ ਉਹ ਖਿ ਖਿਡਾਰੀ ਆ ਉਹ ਆਉਂਦੇ ਆ ਨਾ ਉੱਥੇ ਮਤਲਬ ਆਪਣਾ ਕਬੱਡੀ ਖੇਡ ਖੇਡਣ ਦੇ ਲਈ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਦੂਰੋਂ ਦੂਰੋਂ ਉਸ ਟੂਰਨਾਮੈਂਟ ਨੂੰ ਕਬੱਡੀ ਦੇ ਟੂਰਨਾਮੈਂਟ ਨੂੰ ਦੇਖਣ ਦੇ ਲਈ ਆਉਂਦੇ ਆ ਉੱਥੇ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਆ ਲੋਕ ਉੱਥੇ ਖਾਣ ਪੀਣ ਲਈ ਕੁਛ ਖਰੀਦਦੇ ਆ ਥਾਂ ਥਾਂ ਲੰਗਰ ਲੱਗੇ ਹੁੰਦੇ ਆ ਪਿੰਡ ਦੇ ਵਿੱਚ ਜਦੋਂ ਟੂਰਨਾਮੈਂਟ ਹੁੰਦਾ ਆ ਇਹਨਾਂ ਖਿਡਾਰੀਆਂ ਦੇ ਲਈ ਸਾਰੇ ਪਿੰਡ ਦੇ ਵਿੱਚੋਂ ਕੁਛ ਨਾ ਕੁਛ ਖਾਣ ਦੇ ਲਈ ਇਕੱਠਾ ਕਰਿਆ ਜਾਂਦਾ ਆ ਜਿਵੇਂ ਕਿ ਉਹਨਾਂ ਦੇ ਰਾਸ਼ਨ ਪਾਣੀ ਦੇ ਲਈ ਜਿਹੜੇ ਪਿੰਡ ਦੇ ਲੋਕ ਆ ਉਹ ਆਪਣੇ ਘਰਾਂ ਦੇ ਵਿੱਚੋਂ ਥੋੜ੍ਹਾ ਥੋੜ੍ਹਾ ਰਾਸ਼ਨ ਦਿੰਦੇ ਆ ਆਪਣੇ ਪਲੇ ਜਿਹੜੇ ਖਿਡਾਰੀ ਹੁੰਦੇ ਕਬੱਡੀ ਦੇ ਲਈ ਉਹਨਾਂ ਦੇ ਲਈ ਜਿਵੇਂ ਕਿ ਗੁੜ ਹੋ ਗਿਆ ਦੇਸੀ ਕ ਘਿਓ ਹੋ ਗਿਆ ਆਟਾ ਹੋ ਗਿਆ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਘਰਾਂ ਦੇ ਵਿੱਚੋਂ ਇਕੱਠੀਆਂ ਕਰੀਆਂ ਜਾਂਦੀਆਂ ਆ ਅਤੇ ਜਦੋਂ ਜਿਹੜੇ ਦੂਰ ਦੂਰ ਲੋਕ ਰਹਿੰਦੇ ਆ ਜਿਵੇਂ ਹੁਣ ਪਿੰਡਾਂ ਦੇ ਵਿੱਚੋਂ ਲੋਕ ਸ਼ਹਿਰਾਂ ਦੇ ਵਿੱਚ ਜਾ ਕੇ ਵੱਸਣ ਲੱਗ ਪਏ ਅਤੇ ਜਦੋਂ ਜ ਇਹੋ ਜਿਹੇ ਟੂਰਨਾਮੈਂਟ ਹੁੰਦੇ ਆ ਪਿੰਡਾਂ ਦੇ ਵਿੱਚ ਤਾਂ ਜਦੋਂ ਸ਼ਹਿਰਾਂ ਵਿੱਚੋਂ ਲੋਕ ਹੈ ਜੋ ਉਹ ਆਪਣੇ ਜ ਪ ਜੱਦੀ ਪਿੰਡਾਂ ਦੇ ਵਿੱਚ ਜਾਂਦੇ ਆ ਇਹ ਜਿਹੇ ਟੂਰਨਾਮੈਂਟ ਦੇਖਦੇ ਆ ਉੱਥੇ ਜਿਹੜੇ ਉਹਨਾਂ ਦੇ ਪੁਰਾਣੇ ਭੈਣ ਭਾਈ ਮਿੱਤਰ ਜੋ ਰਹਿੰਦੇ ਆ ਆਪਣੇ ਦੋਸਤ ਹੋ ਗਏ ਉਹਨਾਂ ਨੂੰ ਉਹ ਮਿਲਦੇ ਆ ਇਹਦੇ ਨਾਲ ਭਾਈਚਾਰੇ ਦੀ ਭਾਵਨਾ ਵੱਧਦੀ ਆ ਜਿਵੇਂ ਕਿ ਜਿਹੜੇ ਲੋਕ ਆ ਉਹ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਮਿਲਣ ਦੇ ਲਈ ਜਾਂਦੇ ਆ ਨਾਲੇ ਤਾਂ ਉਹਨਾਂ ਦੇ ਆਪਣੇ ਜੋ ਕ ਮਿੱਤਰ ਹੋ ਗਏ ਉਹਨਾਂ ਨੂੰ ਮਿਲਦੇ ਕਰਦੇ ਆ ਅਤੇ ਨਾਲੇ ਜੋ ਉਹਨਾਂ ਦੇ ਇੰਨਜੋਏਮੈਂਟ ਆ ਅਤੇ ਉਹ ਕਬੱਡੀ ਆ ਜੋ ਉਹ ਦੇਖਦੇ ਆ ਅਤੇ ਫਿਰ ਅੰਤ ਸਮੇਂ ਦੇ ਵਿੱਚ ਜਦੋਂ ਕਬੱਡੀ ਦਾ ਲਾਸਟ ਵਾਲਾ ਟੂਰਨਾਮੈਂਟ ਚੱਲ ਰਿਹਾ ਹੁੰਦਾ ਆ ਉਸ ਟਾਈਮ ਉਸ ਨੂੰ ਕਹਿੰਦੇ ਕਿ ਅਸੀਂ ਕਬੱਡੀ ਆ ਜੋ ਉਹ ਝੰਡੀ ਆ ਜੋ ਕਿਸੇ ਨੇ ਜਿੱਤ ਲਈ ਆ ਅਤੇ ਫਿਰ ਉਸ ਟਾਈਮ ਜਿਹੜੇ ਸਾਰੇ ਪਿੰਡ ਵਾਲੇ ਹੁੰਦੇ ਆ ਉਹ ਬਹੁਤ ਖੁਸ਼ ਹੁੰਦੇ ਆ ਅਤੇ ਛੋਟੇ ਬੱਚੇ ਵੀ ਬਹੁਤ ਖੁਸ਼ ਹੁੰਦੇ ਆ ਸਾਰੇ ਜਣੇ ਟੂਰਨਾਮੈਂਟ ਨੂੰ ਜੋ ਇੰਨਜੋਏ ਕਰਦੇ ਆ